ਹੈਲੋ ਹਾਂਜੀ ਬਾਈ ਕਿਵੇਂ ਹੋ ਵਧੀਆ ਵਧੀਆ ਕੀ ਟੀ ਦੀ ਕਿਹੜੀ ਕਿਹੜੀ ਵਰਾਇਟੀ ਹੈ ਤੁਹਾਡੇ ਕੋਲ ਠੀਕ ਹੈ

ਅੱਛਾ ਅੱਛਾ ਠੀਕ ਹੈ ਅੱਛਾ ਅੱਛਾ ਹਾਂਜੀ ਮਸਾਲਾ ਟੀ ਹੀ ਪੀਣੀ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਅਦਰਕ ਨਾ ਪਾਇਓ ਵਿੱਚ ਬਾਕੀ ਮਸਾਲਾ ਪਾ ਦਿਓ ਹਾਂਜੀ ਹਾਂਜੀ ਅਤੇ ਕੀ ਰੇਟ ਕੀ ਹੈ ਓਕੇ ਓਕੇ ਠੀਕ ਹੈ ਅਤੇ ਕਿੰਨਾ ਟਾਈਮ ਲੱਗੂਗਾ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਚੱਲੋ ਅਸੀਂ ਫਿਰ ਆਉਂਦੇ ਹਾਂ ਹਾਂਜੀ ਹਾਂਜੀ ਬਸ ਠੀਕ ਹੈ ਹਾਂਜੀ ਮੈਮ ਮੇਰੇ ਨਾਲ ਮੇਰੇ ਦੋਸਤ ਵੀ ਹੈ ਤੁਸੀਂ ਚਾਰ ਕੱਪ ਬਣਾ ਦਿਓ ਚਾਹ ਹਾਂਜੀ ਹਾਂਜੀ ਸੇਮ ਫਲੇਵਰ ਦਾ ਹਾਂਜੀ ਹੋਰ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਹੋ

ਠੀਕ ਹੈ ਵਧੀਆ ਕੰਮ ਚੱਲ ਰਿਹਾ ਜੀ ਹਾਂਜੀ ਹਾਂਜੀ ਹਾਂਜੀ ਅਸੀਂ ਇਹਦੀ ਗ੍ਰੈਜੂਏਸ਼ਨ 'ਚ ਅਡਮੀਸ਼ਨ ਕਰਵਾਈ ਹੈ ਹਾਂਜੀ ਹਾਂਜੀ ਵਧੀਆ ਵਧੀਆ ਚਾਹ ਬਣਾ ਕੇ ਦਿਓ ਫਿਰ ਟੇਸਟ ਕਰਾਂਗੇ ਹਾਂਜੀ ਹਾਂਜੀ ਹਾਂਜੀ ਮੈਨੂੰ ਇਸ ਦੁਕਾਨ 'ਤੇ ਹੀ ਵਾਵਾ ਰੱਛ ਜਿਹਾ ਲੱਗਿਆ ਹਾਂਜੀ ਤਾਹੀਂ ਮੈਂ ਆਇਆ ਅੱਛਾ ਅੱਛਾ ਠੀਕ ਅੱਛਾ ਅੱਛਾ ਠੀਕ ਹੈ ਜੀ ਬਸ ਬਣਾ ਦਿਓ ਫਿਰ ਚਾਰ ਕੱਪ ਹਾਂਜੀ ਠੀਕ ਠੀਕ ਹੈ ਜੀ ਕੰਮ ਕਰਦੇ ਹਾਂਜੀ ਹਾਂਜੀ ਬਿਸਕਿਟ ਦੇ ਦਿਓ ਹਾਂਜੀ ਠੀਕ ਹੈ ਜੀ ਠੀਕ ਹੈ ਕੋਈ ਨਾ ਹਾਂਜੀ ਥੋੜ੍ਹਾ ਜਲਦੀ ਬਣਾ ਦਿਓ ਜੀ ਮੇਰਾ ਲੈਕਚਰ ਹੈ ਨੌਰਮਲ ਹੀ ਕੋਈ ਵੀ ਹੈਗੇ ਹੈ ਤਾਂ ਜਿਵੇਂ ਗੁੱਡੇ ਹੋ ਗਏ ਐਵੇਂ ਨਾਈਸ ਕੋਈ